ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਡਮ ਜੀ ਤੁਸੀਂ ਆਹ ਪੰਜਾਬ ਦੇ ਜਿਹੜੇ ਪ੍ਰਸਿੱਧ ਐਕਟਰ ਆ ਉਹਨਾਂ ਬਾਰੇ ਕੁਛ ਦੱਸ ਸਕਦੇ ਆ ਮਤਲਬ ਉਹਨਾਂ ਬਾਰੇ ਜਾਣਕਾਰੀ ਦੇ ਸਕਦੇ ਜੀ

ਹਾਂਜੀ

ਹਾਂਜੀ ਪੰਜਾਬ ਦੇ ਨਾਮ ਨਾਲ ਨਾਲ ਨਾਲ ਕਰਨਾ ਹਿੰਦੀ ਫਿਲਮਾਂ 'ਚ ਕੰਮ ਕਰਕੇ ਨਾਮ ਰੌਸ਼ਨ ਕਰ ਰਹੇ ਪੰਜਾਬ ਦਾ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਪੰਜਾਬ ਦਾ ਪਿੰਡ ਦਾ ਆਪਣੇ ਬਹੁਤ ਹਾਂਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਜਾਣਕਾਰੀ ਦੇਣ ਲਈ